ਫੋਟੋਗ੍ਰਾਫੀ ਸ਼ੁਰੂ ਕਰਨ ਲਈ ਜਿਹੜੀ ਪ੍ਰੇਰਨਾ ਹੈ ਉਹ ਮੈਨੂੰ ਆਪਣੇ ਦੋਸਤਾਂ ਕੋਲੋਂ ਮਿਲੀਆਂ ਮੇਰੇ ਦੋਸਤ ਜਿਹੜੇ ਸਨ ਉਹ ਬਹੁਤ ਸੋਹਣੀਆਂ ਫੋਟੋਆਂ ਖਿੱਚਦੇ ਸਨ ਕਦੀ ਕਿਤੇ ਕੋਈ ਕਬੂਤਰ ਕਦੀ ਕਿਤੇ ਕੋਈ ਚਿੜੀਆਂ ਕਦੀ ਕੋਈ ਫੁੱਲ ਕਦੀ ਕੋਈ ਅਸਮਾਨ ਇਹਨਾਂ ਚੀਜ਼ਾਂ ਦੀਆਂ ਬਹੁਤ ਸੋਹਣੀਆਂ ਫੋਟੋਆਂ ਖਿੱਚਦੇ ਸਨ ਜਿਸ ਤੋਂ ਮੈਨੂੰ ਵੀ ਪ੍ਰੇਰਨਾ ਮਿਲੀ ਅਤੇ ਮੈਂ ਵੀ ਫੋਟੋ ਖਿੱਚਣ ਦੀ ਚਾਹਵਾਨ ਬਣੀ ਦੂਸਰੀ ਪ੍ਰੇਰਨਾ ਮੈਨੂੰ ਸੋਸ਼ਲ ਮੀਡੀਆ ਤੋਂ ਮਿਲੀ ਜਿੱਥੇ ਮੈਂ ਲੋਕਾਂ ਦੀਆਂ ਪੋਸਟ ਕੀਤੀਆਂ ਹੋਈਆਂ ਰੀਲਸ ਅਤੇ ਸਟੋਰੀਜ ਦੇਖਦੀ ਜਿਹਦੇ ਕਰਕੇ ਮੈਨੂੰ ਪ੍ਰੇਰਨਾ ਮਿਲਦੀ ਕਿ ਮੈਂ ਵੀ ਬਹੁਤ ਸੋਹਣੀਆਂ ਫੋਟੋਆਂ ਖਿੱਚਾਂ ਕੋਈ ਸਪੈਸ਼ਲ ਥੀਮ ਮੇਰੇ ਕੋਲ ਹਾਸਿਲ ਕਰਨ ਲਈ ਜਾਂ ਸੋਚਣ ਲਈ ਇਹ ਹੈ ਕਿ ਮੈਂ ਪਹਾੜਾਂ ਦੀਆਂ ਸਮੁੰਦਰਾਂ ਦੀਆਂ ਅਤੇ ਨਦੀਆਂ ਦੀਆਂ ਫੋਟੋਆਂ ਖਿੱਚਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਮੈਨੂੰ ਇਹ ਚੀਜ਼ਾਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਨੇਚਰ ਹੋ ਗਈ ਕੁਦਰਤ ਹੋ ਗਈ ਅਸਮਾਨ ਹੋ ਗਿਆ ਬੱਦਲ ਹੋ ਗਏ ਇਹ ਚੀਜ਼ਾਂ ਮੈਨੂੰ ਫੋਟੋ ਖਿੱਚਣ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਅਤੇ ਮੈਨੂੰ ਇਹਨਾਂ ਦੀਆਂ ਫੋਟੋਆਂ ਖਿੱਚ ਕੇ ਖੁਸ਼ੀ ਵੀ ਬਹੁਤ ਮਿਲਦੀ ਹੈ